ਪਿੰਡਾਂ ਤੁਸੀਂ ਨੇੜੇ ਕਸਬਿਆਂ ਪਿੰਡਾਂ ਦਾ ਕਿੰਨੀ ਵਾਰ ਦੌਰਾ ਕਰਦੇ ਹੋ ਅਤੇ ਕਿਹੜੇ ਉਦੇਸ਼ਾਂ ਲਈ ਜਾਂਦੇ ਹੋ ਚ ਅਸੀਂ ਪਿੰਡਾਂ ਵਿੱਚ ਸਾਲ 'ਚ ਇੱਕ ਦੋ ਵਾਰ ਜਾਂਦੇ ਹਾਂ ਅਤੇ ਉੱਥੋਂ ਦਾ ਸਾਨੂੰ ਮਾਹੌਲ ਬਹੁਤ ਵਧੀਆ ਲੱਗਦਾ ਹੈ ਅਤੇ ਇੱਕ ਤਾਂ ਪ੍ਰਦੂਸ਼ਣ ਤੋਂ ਰਹਿਤ ਹੁੰਦੇ ਹਨ ਪਿੰਡ ਤਾਜ਼ਾ ਵਾਤਾਵਰਨ ਹੁੰਦਾ ਹੈ ਅਤੇ ਸ਼ਾਂਤ ਸੁਭਾਅ ਦੇ ਲੋਕ ਹੁੰਦੇ ਹਨ ਸ਼ੁੱਧ ਪੰਜਾਬੀ ਬੋਲਦੇ ਬਹੁਤ ਵਧੀਆ ਉਹਨਾਂ ਦੀ ਭਾਸ਼ਾ ਹੁੰਦੀ ਹੈ ਅਤੇ ਬਹੁਤ ਵਧੀਆਂ ਉਹਨਾਂ ਦੀ ਭਾਸ਼ਾ ਹੁੰਦੀ ਹੈ ਅਤੇ ਇੱਕ ਉਹਨਾਂ ਦਾ ਖਾਣ ਪੀਣ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਹਨ ਤਾਜ਼ਾ ਸਭ ਕੁਛ ਮਤਲਬ ਕੀ ਮਿਲਾਵਟ ਤੋਂ ਦੂਰ ਘਰ ਦਾ ਖਾਣ ਪੀਣ ਵਧੀਆ ਹੁੰਦਾ ਹੈ ਸਭ ਕੁਛ ਉਹਨਾਂ ਦਾ ਅਤੇ ਬਹੁਤ ਵਧੀਆ ਮਾਹੌਲ ਲੱਗਦਾ ਹੈ ਪਿੰਡਾਂ ਦਾ ਸਾਨੂੰ ਅਤੇ ਇਸ ਲਈ ਅਸੀਂ ਕਦੇ ਕਦੇ ਉਹਨਾਂ ਦੇ ਪਿੰਡਾਂ ਵਿੱਚ ਜਾਂਦੇ ਹਾਂ